ਹੈਲੋ ਹਾਂਜੀ ਸਰ ਤੁਸੀਂ ਵੋਟਰ ਸਪਲਾਈ ਦੀ ਤਰਫ ਤੋਂ ਬੋਲ ਰਹੇ ਹੋ ਕੰਪਨੀ ਤੋਂ ਸਰ ਮੈਂ ਕੰਪਲੇਨ ਕਰਨੀ ਸੀ ਤੁਹਾਡੇ ਵਾਟਰ ਬਾਰੇ ਕਿ ਕਾਫੀ ਦਿਨ ਹੋ ਗਏ ਆਲਮੋਸਟ ਇੱਕ ਮੰਨਥ ਹੋ ਜਾਏਗਾ ਸਾਡੇ ਪਾਣੀ ਦਾ ਕੋਈ ਵੀ ਸਾਫ ਨਹੀਂ ਹੋਇਆ ਕਦੇ ਆ ਜਾਂਦਾ ਕਦੇ ਨਹੀਂ ਆਉਂਦਾ ਕਦੇ ਦੋ ਦਿਨ ਨਹੀਂ ਆਉਂਦਾ ਕਦੇ ਤਿੰਨ ਦਿਨ ਨਹੀਂ ਆਉਂਦਾ ਕਦੇ ਨਾ ਦਿਨ ਦੇ ਟਾਈਮ ਹੁੰਦਾ ਸੀ ਟਾਈਮ ਵੀ ਨਹੀਂ ਹੁੰਦਾ ਕਦੇ ਸਵੇਰੇ ਵਾਲੇ ਨੇ ਕਦੇ ਸ਼ਾਮ ਨੂੰ ਆ ਜਾਂਦਾ ਸਰ ਇਹ ਤੁਸੀਂ ਦੱਸੋ ਕੀ ਇਸ਼ੂ ਆ ਰਿਹਾ ਬੈਕ ਐਂਡ 'ਤੇ ਤੁਹਾਡੇ ਹਾਂਜੀ ਹਾਂਜੀ ਹਾਂਜੀ ਉਹ ਤਾਂ ਮੈਥੋਂ ਪਰ ਤੁਸੀਂ ਵਿੱਚੋਂ ਵਿੱਚ ਸਪਲਾਈ ਕਰਦੇ ਹੋ ਪਰ ਉਹ ਮੈਂ ਚਾਹੁੰਦਾ ਤੁਸੀਂ ਪ੍ਰੋਪਰ ਕਰਿਆ ਕਰੋ ਇੱਕ ਟਾਈਮ ਫਿਕਸ ਕਰ ਲਓ ਤੁਹਾਡਾ ਕਿਉਂਕਿ ਐਵੇਂ ਬਹੁਤ ਦਿੱਕਤ ਆਉਂਦੀ ਹੈ

ਹਾਂਜੀ ਹਾਂਜੀ ਉਹ ਤਾਂ ਠੀਕ ਹੈ ਜੀ ਹਾਂਜੀ ਪਰ ਇਸ਼ੂ ਇਹ ਹੈਗਾ ਕਿ ਹੁਣ ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸਵੇਰੇ ਪਾਣੀ ਨਹੀਂ ਆਉਂਦਾ ਤਾਂ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਕੋਈ ਤੁਸੀਂ ਅਲਟਰਨੇਟਿਵ ਤੁਸੀਂ ਪ੍ਰੋਵਾਈਡ ਕਰੋ ਕੁਝ ਨਾ ਕਰੋ ਸਾਨੂੰ ਕਿਉਂਕਿ ਕਹਿ ਕੇ ਤੁਹਾਡੇ ਕੋਲ ਹੁਣੇ ਨਹੀਂ ਹੁੰਦਾ ਕੱਲ੍ਹ ਸਾਨੂੰ ਅਲਟਨੇਟਿਵ ਵੀ ਤਾਂ ਦੇਣਾ ਚਾਹੀਦਾ ਤੁਹਾਨੂੰ ਕਿਸੇ ਟੈਂਕ ਵਾਟਰ ਟੈਂਕ ਭੇਜੋ ਜਾਂ ਕੁਝ ਹੋਰ ਕੰਪਨੀ ਨਾਲ ਗੱਲ ਕਰੋ ਕੁਝ ਕਰੋ ਤੁਸੀਂ

ਹਾਂਜੀ ਠੀਕ ਹੈ ਸਰ ਜੀ ਸਰ ਅਗਰ ਹੁਣ ਇਹ ਦੋ ਤਿੰਨ ਦਿਨ ਲੱਗਣੇ ਨੇ ਤਾਂ ਤੁਸੀਂ ਇੱਕ ਐਵੇਂ ਵੀ ਕਰ ਸਕਦੇ ਵਾਟਰ ਟੈਂਕ ਤੁਹਾਡੇ ਕੋਲ ਅਡਵਾਂਸ 'ਚ ਸਾਡੇ ਕੋਲ ਭੇਜ ਦਿਆ ਕਰੋ ਕਿਉਂਕਿ ਸਾਨੂੰ ਫਿਰ ਆਪਦੀ ਤਰਫ ਤੋਂ ਮੰਗਵਾਉਣਾ ਪੈਂਦਾ ਏ ਬਹੁਤ ਦਿੱਕਤ ਆਉਂਦੀ ਹੈ ਸਰ ਤੁਸੀਂ ਸਾਨੂੰ ਪ੍ਰੋਵਾਈਡ ਕਰਕੇ ਦਿਓ ਫਿਰ ਇਹ ਹਾਂਜੀ ਹਾਂਜੀ ਸਰ ਦਾ ਵੇਖ ਲਿਆ ਜੀ ਅਤੇ ਬਸ ਮੈਂ ਹੀ ਹੈਗੀ ਕਿ ਮੈਨੂੰ ਦੁਬਾਰਾ ਇਸ਼ੂ ਨਾ ਆਏ ਕਿਉਂਕਿ ਉਹ ਦਿੱਕਤ ਆ ਰਹੀ ਬੱਚਿਆਂ ਦੀ ਵੀ ਬਹੁਤ ਦਿੱਕਤ ਆ ਰਹੀ ਤੁਹਾਨੂੰ ਪਤਾ ਹੀ ਹੋਵੇ ਹਾਂਜੀ ਹਾਂਜੀ ਠੀਕ ਹੈ ਸਰ ਬਸ ਅੱਗੇ ਤੋਂ ਸਰ ਤੁਸੀਂ ਇਹ ਧਿਆਨ ਰੱਖਿਓ ਜੀ ਕਿ ਇਹ ਸਾਨੂੰ ਇਸ਼ੂ ਦੁਬਾਰਾ ਨਾ ਵੇਖਣ ਨੂੰ ਮਿਲੇ ਠੀਕ ਹੈ ਸਰ ਥੈਂਕ ਯੂ